ਮੈਂ ਚਾਹੁੰਦੀ ਹਾਂ ਕਿ ਸਾਡੇ ਇਲਾਕੇ ਵਿੱਚ ਇੱਕ ਵੱਡਾ ਜਿਹਾ ਮੋਲ ਹੋਵੇ ਜਿਸ ਵਿੱਚ ਕਿ ਸਾਰੇ ਸੈਲਾਨੀ ਆਉਣ 'ਤੇ ਸਾਡੇ ਇਲਾਕੇ ਵਿੱਚ ਸੈਰ ਸਪਾਟੇ ਦਾ ਵਧ ਵਧਾਈ ਵਾਧਾ ਹੋਏ ਔਰ ਮੈਂ ਇਹ ਵੀ ਚਾਹੁੰਦੀ ਹਾਂ ਕਿ ਸਾਡੇ ਇਲਾਕੇ ਵਿੱਚ ਕੋਈ ਵੱਡਾ ਜਿਹਾ ਕਾਲਜ ਖੁਲ੍ਹੇ ਤਾਂ ਕਿ ਸਾਡੇ ਪਿੰਡ ਦੇ ਲੋਕਾਂ ਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਾ ਪਵੇ ਔਰ ਸਾਡੇ ਇਲਾਕੇ ਵਿੱਚ ਸਕੂਲਾਂ ਦੀ ਵੀ ਹਾਲਤ ਠੀਕ ਕੀਤੀ ਜਾਏ ਤਾਂ ਕਿ ਬੱਚਿਆਂ ਨੂੰ ਚੰਗੀ ਤੋਂ ਚੰਗੀ ਸ਼ਿਕਸ਼ਾ ਪ੍ਰਾਪਤ ਹੋ ਸਕੇ ਕਿਉਂਕਿ ਸਾਡੇ ਇਲਾਕੇ ਦੇ ਬੱਚੇ ਦਿਨ ਬ ਦਿਨ ਵਿਗੜਦੇ ਜਾ ਰਹੇ ਹਨ ਔਰ ਮੈਂ ਚਾਹੁੰਦੀ ਹਾਂ ਕਿ ਸਾਡੇ ਇਲਾਕੇ ਵਿੱਚ ਕੋਈ ਕੰਮ ਕਰਨ ਦੀ ਸੁਵਿਧਾ ਵਧੇ ਕਿਉਂਕਿ ਸਾਡੇ ਇੱਧਰ ਵੀਹ ਤੋਂ ਪੱਚੀ ਔਰ ਤੀਹ ਤੱਕ ਦੇ ਲੋਕਾਂ ਲਈ ਰੁਜ਼ਗਾਰ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜਿਸ ਕਰਕੇ ਲੋਕ ਫਾਲਤੂ ਵਿੱਚ ਹੀ ਇੱਧਰ ਉੱਧਰ ਵਿਹਲੇ ਹੀ ਘੁੰਮਦੇ ਰਹਿੰਦੇ ਹਨ ਔਰ ਉਹਨਾਂ ਨੂੰ ਕੋਈ ਕੰਮਕਾਰ ਨਹੀਂ ਹੁੰਦਾ ਜਿਸ ਕਰਕੇ ਉਹ ਨਸ਼ਿਆਂ ਦੇ ਚੱਕਰ ਵਿੱਚ ਫਸਦੇ ਜਾ ਰਹੇ ਹਨ ਅਤੇ ਜੁਆ ਆਦਿ ਦੇ ਵੀ ਚੱਕਰਾਂ ਵਿੱਚ ਫਸਦੇ ਜਾ ਰਹੇ ਹਨ ਜਿਹਨਾਂ ਨੂੰ ਦੇਖ ਦੇਖ ਕੇ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਉਹਨਾਂ ਕੰਮਾਂ ਵਿੱਚ ਪੈਂਦੀ ਜਾ ਰਹੀ ਹੈ ਸਭ ਤੋਂ ਜ਼ਿਆਦਾ ਵੱਡਾ ਕਾਰਨ ਇਹੀ ਹੈ ਕਿ ਉਹ ਵਿਹਲੇ ਰਹਿੰਦੇ ਹਨ ਉਹਨਾ ਨੂੰ ਦੇਖ ਦੇਖ ਦੇ ਕੇ ਸਾਡੇ ਛੋਟੇ ਬੱਚੇ ਵੀ ਵਿਗੜਦੇ ਜਾ ਰਹੇ ਹਨ ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਸਾਡੇ ਇੱਧਰ ਵਿਕਸ ਵਿਕਸਿਤ ਇਲਾਕਿਆਂ ਵਾਂਗ ਵੱਡੀ ਵੱਡੀ ਕੰਪਨੀਜ ਜਾਂ ਫਿਰ ਕੋਈ ਫੈਕਟਰੀ ਲੱਗੇ ਜਿਸ ਨਾਲ ਸਾਡੇ ਇਲਾਕੇ ਦੇ ਲੋਕਾਂ ਨੂੰ ਕੋਈ ਰੁਜ਼ਗਾਰ ਮਿਲੇ ਕੋਈ ਜਿੱਦਾਂ ਕਿ ਸਾਡੇ ਇੱਧਰ ਅਗਰ ਕੋਈ ਸੈਰ ਸਪਾਟੇ ਵਾਲੀ ਜਗ੍ਹਾ ਬਣਦੀ ਹੈ ਤਾਂ ਲੋਕਾਂ ਨੂੰ ਹੋਰ ਵੀ ਜ਼ਿਆਦਾ ਰੁਜ਼ਗਾਰ ਦਾ ਸਾ ਸਾਧਨ ਮਿਲੇਗਾ ਜਿੱਦਾਂ ਕੋਈ ਮੋਲ ਖੁਲ੍ਹੇਗਾ ਤਾਂ ਲੋਕਾਂ ਨੂੰ ਉਸ ਵਿੱਚ ਕੰਮ ਕਰਨ ਦਾ ਉਤਸੁਕਤਾ ਜਾਗੇਗੀ ਔਰ ਉਹਨਾਂ ਨੂੰ ਰੁਜ਼ਗਾਰ ਮਿਲੇਗਾ ਕੋਈ ਫੈਕਟਰੀ ਖੁਲ੍ਹੇਗਾ ਤਾਂ ਲੋਕ ਉੱਥੇ ਜਾ ਕੇ ਕੰਮ ਕਰਨਗੇ ਔਰ ਨਾਲ ਦੀ ਨਾਲ ਸੈਰ ਸਪਾਟੇ ਦਾ ਵੀ ਵਧਾ ਵਧਾਓ ਹੋਏਗਾ ਔਰ ਸਾਡੇ ਇੱਧਰ ਟਰਾਂਸਪੋਰਟ ਵੀ ਚੱਲਣ ਲੱਗਣਗੇ ਜਿਹਨਾਂ ਕਰਕੇ ਕਿ ਸਾਡੇ ਇੱਥੇ ਰਹਿੰਦੇ ਲੋਕਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਔਰ ਬਾਹਰ ਦੇ ਲੋਕਾਂ ਨੂੰ ਵੀ ਇੱਥੇ ਆ ਕੇ ਮਜ਼ਾ ਆਏਗਾ ਧੰਨਵਾਦ